ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਬਸ ਹਾਂਜੀ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਕੀ ਹਾਲ ਚਾਲ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਆਪਣਾ ਪਰਿਵਾਰ ਹਾਂਜੀ ਹਾਂਜੀ ਵਧੀਆ ਬਿਲਕੁਲ ਵੀਰ ਜੀ ਮੈਂ ਨਾ ਤੁਹਾਡੇ ਕੋਲੋਂ ਪੁੱਛਣਾ ਫਿਰੋਜ਼ਪੁਰ ਬਾਰੇ ਬਾਰੇ ਮੈਂ ਪੁੱਛ ਸੁਣਿਆ ਤਾਂ ਬਹੁਤ ਕੁਛ ਸੀ ਪਰ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਤੁਸੀਂ ਮੈਨੂੰ ਕੋਈ ਜਾਣਕਾਰੀ ਦੇ ਸਕਦੇ ਕੋਈ ਹਾਂਜੀ ਕੋਈ ਹਿਸਟਰੀ ਦੱਸ ਸਕਦੇ ਹਾਂਜੀ ਫਿਰੋਜ਼ਪੁਰ ਦਾ ਆਪਣਾ ਇਤਿਹਾਸ ਕੋਈ ਦੱਸ ਹਾਂਜੀ ਠੀਕ ਨੇ ਠੀਕ ਠੀਕ ਵੀਰ ਜੀ ਠੀਕ ਜੀ ਠੀਕ ਵੀਰ ਜੀ ਠੀਕ ਜੀ ਠੀਕ ਵੀਰ ਜੀ ਹਾਂਜੀ ਠੀਕ ਵੀਰ ਜੀ ਠੀਕ ਵੀਰ ਜੀ ਠੀਕ ਵੀਰ ਜੀ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਠੀਕ ਹੈ ਠੀਕ ਹੈ ਜੀ ਠੀਕ ਜੀ ਠੀਕ ਹੈ ਅਤੇ ਵੀਰ ਜੀ ਉੱਥੇ ਸਾਰਾਗੜ੍ਹੀ ਵੀ ਗੁਰਦੁਆਰਾ ਸਾਹਿਬ ਦਾ ਕਹਿ ਰਹੇ ਸੀ ਹੈਗਾ ਹਾਂਜੀ ਠੀਕ ਠੀਕ ਜੀ ਠੀਕ ਜੀ ਹਾਂਜੀ ਹਾਂਜੀ ਠੀਕ ਠੀਕ ਜੀ ਹਾਂਜੀ ਹਾਂਜੀ

ਠੀਕ ਹੈ ਠੀਕ

ਠੀਕ ਹੈ ਠੀਕ ਹੈ

ਬਸ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਹਾਂਜੀ ਹਾਂਜੀ ਠੀਕ

ਹੁੰ

ਠੀਕ ਵੀਰੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ